ਇੱਥੇ ਮਛੇਰਿਆਂ ਦੀਆਂ ਦੋ ਤਰ੍ਹਾਂ ਦੀਆਂ ਜਾਤਾਂ ਹੁੰਦੀਆਂ ਨੇ ਹਿੰਦੂ ਅਤੇ ਮੁਸਲਿਮ ਜਿਹੜੇ ਤਾਂ ਹਿੰਦੂ ਮਛੇਰੇ ਹੁੰਦੇ ਹਨ ਉਹ ਹਿੰਦੂ ਰੀਤੀ ਰਿਵਾਜ਼ਾਂ ਨਾਲ ਆਪਣੇ ਤਿਉਹਾਰ ਮਨਾਉਂਦੇ ਹਨ ਅਤੇ ਜਿਹੜੇ ਮੁਸਲਿਮ ਮਛੇਰੇ ਹੁੰਦੇ ਹਨ ਉਹ ਮੁਸਲਿਮ ਰੀਤੀ ਰਿਵਾਜ਼ਾਂ ਨਾਲ ਆਪਣੇ ਤਿਉਹਾਰ ਮਨਾਉਂਦੇ ਹਨ ਅਤੇ ਇਹ ਇਕੱਠੇ ਮਿਲ ਜੁਲ ਕੇ ਰਹਿੰਦੇ ਹਨ ਅਤੇ ਇਹਨਾਂ ਦੀ ਜ਼ਿਆਦਾਤਰ ਸਮੁੰਦਰਾਂ ਦੇ ਨੇੜੇ ਤੇੜੇ ਰਿਹਾਇਸ਼ ਦੇ ਸਥਾਨ ਬਣਾਏ ਹੁੰਦੇ ਹਨ